ਚੌਦ੍ਹਾਂ ਅਕਤੂਬਰ ਉਨੀ ਸੌ ਨੜਿਨਵੇਂ ਪੰਦਰਾਂ ਨਵੰਬਰ ਉਨੀ ਸੌ ਸਤੱਤਰ ਇੱਕ ਦਸੰਬਰ ਉਨੀ ਸੌ ਅਠੱਤਰ ਇੱਕੀ ਅਕਤੂਬਰ ਦੋ ਹਜ਼ਾਰ ਵੀਹ ਦਸੰਬਰ ਉਨੀ ਸੌ ਅਠੱਤਰ